ਹੈਲੋ ਹੈਲੋ ਹਾਂਜੀ ਭਾਅ ਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਦੱਸੋ ਜੀ ਹਾਂਜੀ ਦੱਸੋ ਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਦੁਕਾਨ ਸਰ ਉੱਦਾਂ ਤੇ ਅਸੀਂ ਸਵੇਰੇ ਦਸ ਵਜੇ ਖੋਲ ਲੈਂਦੇ ਹਾਂ ਰਾਤ ਦੇ ਅੱਠ ਵਜੇ ਤੱਕ ਹੋਈਦਾ ਤੁਸੀਂ ਜਦੋਂ ਮਰਜ਼ੀ ਆ ਕੇ ਲੈ ਸਕਦੇ ਹੋ ਸੰਡੇ ਨੂੰ ਅਸੀਂ ਇਹ ਦੁਪਹਿਰੇ ਦੋ ਵਜੇ ਤੱਕ ਹੁੰਦੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਇਹ ਤੁਹਾਨੂੰ ਕਿਹੜੇ ਡੋਕਟਰ ਨੇ ਲਿਖੀ ਹੈ ਡਾਕਟਰ ਸੁਰੇਸ਼ ਸ਼ਰਮਾ ਨੇ ਲਿਖੀ ਹੈ ਅੱਛਾ ਜੀ ਐਕਚੁਲੀ ਹੈਗੀ ਦਵਾਈ ਇਹ ਗੈਸ ਵਾਸਤੇ ਹੁੰਦੀ ਹੈ ਅਤੇ ਜਿੱਦਾਂ ਕੋਈ ਕੋਈ ਕਿਤੇ ਬਜ਼ਾਰ ਦੇ ਖਾ ਲਏ ਕੋਈ ਤਲਿਆ ਤੁਲਿਆ ਖਾ ਲਿਆ ਅਤੇ ਪੇਟ ਦੇ ਵਿੱਚ ਗੈਸ ਬਣ ਜਾਂਦੀ ਹੈ ਉਹ ਗੈਸ ਨੂੰ ਨਿਊਟੀਲਾਈਜ਼ ਕਰਨ ਵਾਸਤੇ ਹੁੰਦੀ ਹੈ ਕੋਈ ਜੈ ਜੈਲੋਸਿਲ ਟਾਈਪ ਹੀ ਆ ਕੋਈ ਇਹੋ ਜਿਹੀ ਅਤੇ ਬ ਹਾਰਟ ਹਾਰਟ ਕੈਮੀਕਲ ਨਹੀਂ ਹੈਗਾ ਬੜਾ ਸੋਫਟ ਕੈਮੀਕਲ ਹੈ ਹਾਂ ਬੱਚੇ ਨੂੰ ਵੀ ਦੇ ਸਕਦੇ ਲੇਡੀਜ ਖਾ ਸਕਦੇ ਹੈ ਜੈਂਟਸ ਵੀ ਲੈ ਸਕਦੇ ਹੈ ਕੋਈ ਐਸੀ ਗੱਲ ਨਹੀਂ ਪੇਟ ਦੀ ਕਿ ਜਿੱਦਾਂ ਇਹ ਲੈ ਸਕਦੇ ਹੋ ਤੁਸੀਂ ਇਹਨੂੰ ਸੱਠ ਸਾਲ ਸੱਤਰ ਸਾਲ ਓ ਓਲਡ ਏਜ ਵੀ ਲੈ ਸਕਦੇ ਯੰਗ ਯੰਗਮੈਨ ਵੀ ਲੈ ਸਕਦੇ ਗੈਸ 'ਚ ਅਤੇ ਕਦੇ ਵੀ ਜਦੋਂ ਵੀ ਹੋ ਜੇ ਓ ਓਨ ਦਾ ਜਦੋਂ ਲੋੜ ਪਈ ਬੰਦਾ ਖਾ ਲੈਂਦਾ ਉਸ ਟੈਮ ਪੀ ਲੈਂਦਾ ਹੈ ਦੋ ਚਮਚੇ ਹਾਂਜੀ ਇਹ ਸਰ ਰੋਟੀ ਖਾਣ ਤੋਂ ਅ ਪਹਿਲੇ ਵੀ ਲੈ ਸਕਦੇ ਹੋ ਦੋ ਚਮਚੇ ਅਤੇ ਜਦੋਂ ਜੇ ਗੈ ਰੋਟੀ ਖਾਣ ਤੋਂ ਬਾਅਦ ਜਦੋਂ ਗੈਸ ਜ਼ਿਆਦਾ ਹੁੰਦੀ ਆ ਤਾਂ ਬਾਅਦ ਚੋਂ ਵੀ ਲੈ ਸਕਦੇ ਹੋ ਦਿਨ 'ਚ ਵੈਸੇ ਤਿੰਨ ਟਾਈਮ ਹੁੰਦੀ ਹੈ ਦੋ ਦੋ ਚਮਚੇ ਹਾਂ ਜਦੋਂ ਗੈਸ ਤੁਹਾਨੂੰ ਲੱਗੇ ਹੋਈ ਹੈ ਪੇਟ 'ਚ ਤਾਂ ਤੁਸੀਂ ਲੈ ਸਕਦੇ ਹੋ ਜਿੱਦਾਂ ਪੇਟ ਦੁੱਖਦਾ ਹੁੰਦਾ ਕਿਸੇ ਵੇਲੇ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਥੈਂਕ ਯੂ